ਹਾਂਜੀ ਅਜਿਹੇ ਆਸਣ ਜੋ ਲਚਕਤਾ ਵਧਾਉਂਦੇ ਹਨ ਸਾਡੇ ਸਰੀਰ ਨੂੰ ਬਹੁਤ ਹੀ ਜ਼ਰੂਰੀ ਹਨ ਸਾਡੇ ਸਰੀਰ ਵਿੱਚ ਲਚਕਤਾ ਹੋਣੀ ਬਹੁਤ ਜ਼ਰੂਰੀ ਹੈ ਜਿਸ ਨਾਲ ਸਾਡੇ ਸਰੀਰ ਤੰਦਰੁਸਤ ਰਹੇ ਅਤੇ ਅਸੀਂ ਆਪਣਾ ਜ਼ਿੰਦਗੀ ਨੂੰ ਵਧੀਆ ਗੁਜ਼ਾਰ ਸਕੀਏ ਇਸ ਲਈ ਸਾਨੂੰ ਆਪਣੇ ਸਰੀਰ ਨੂੰ ਲਚਕਦਾਰ ਬਣਾਉਣ ਲਈ ਆਸਣ ਕਰਨੇ ਬਹੁਤ ਜ਼ਰੂਰੀ ਹਨ ਇਹਨਾਂ ਵਿੱਚ ਜਿਵੇਂ ਤਾੜ ਆਸਣ ਹੈ ਇਸ ਆਸਣ ਵਿੱਚ ਅਸੀਂ ਆਪਣੇ ਪੱਬਾਂ 'ਤੇ ਖੜ੍ਹੇ ਹੋ ਕੇ ਅਤੇ ਅੱਡੀਆਂ ਤਾਹਾਂ ਚੁੱਕ ਕੇ ਹੱਥ ਉੱਪਰ ਜੋੜ ਕੇ ਕਰਦੇ ਹਾਂ ਇਸ ਨਾਲ ਸਰੀਰ ਵਿੱਚ ਲਚਕਤਾ ਆਉਂਦੀ ਹੈ ਧਨੁਸ਼ ਆਸਣ ਇਸ ਦੇ ਵਿੱਚ ਇਨਸਾਨ ਪਹਿਲਾਂ ਮੁੱਧਾ ਪੈਂਦਾ ਹੈ ਫੇਰ ਆਪਣੇ ਹੱਥਾਂ ਨਾਲ ਪਿੱਛੇ ਦੀ ਆਪਣੇ ਪੈਰਾਂ ਨੂੰ ਫੜ ਕੇ ਇਕ ਅਰਧ ਚੱਕਰ ਬਣਾ ਲੈਂਦਾ ਹੈ ਜਿਸ ਨੂੰ ਧਨੁਸ਼ ਆਸਣ ਕਹਿੰਦੇ ਹਨ ਭੁਜੰਗ ਆਸਣ ਇਹ ਵੀ ਸਰੀਰ ਵਿੱਚ ਲਚਕਤਾ ਲਿਆਉਂਦਾ ਹੈ ਇਸ ਵਿੱਚ ਅਸੀਂ ਮੁੱਧੇ ਪੈ ਕੇ ਅਤੇ ਆਪਣੇ ਸਰੀਰ ਨੂੰ ਮੂਹਰਲਾ ਪਾਸਾ ਸਿਰ ਨੂੰ ਉੱਪਰ ਚੁੱਕ ਕੇ ਹੱਥ ਥੱਲੇ ਲਗਾ ਕੇ ਕਰਦੇ ਹਾਂ ਇਸ ਨਾਲ ਸਰੀਰ ਵਿੱਚ ਲਚਕਤਾ ਆਉਂਦੀ ਹੈ ਅਤੇ ਪੇਟ ਵੀ ਇਸ ਨਾਲ ਨਹੀਂ ਵੱਧਦਾ ਇਸ ਨਾਲ ਕਰਨ ਨਾਲ ਸਾਡੇ ਸਰੀਰ ਵਿੱਚ ਲਚਕਤਾ ਆਉਂਦੀ ਰਹਿੰਦੀ ਹੈ ਅਤੇ ਸਰੀਰ ਠੀਕ ਰਹਿੰਦਾ ਹੈ ਬੀਰਭਦਰ ਆਸਣ ਇਹ ਵੀ ਸਰੀਰ ਵਿੱਚ ਲਚਕਤਾ ਲਿਆਉਂਦਾ ਹੈ ਜਿਸ ਨਾਲ ਸਰੀਰ ਵਿੱਚ ਆਪਣਾ ਲਚਕਦਾਰ ਬਣਦਾ ਹੈ ਇਸ ਤਰ੍ਹਾਂ ਸਾਨੂੰ ਹੋਰ ਵੀ ਕਈ ਤਰ੍ਹਾਂ ਦੇ ਆਸਣ ਸਰੀਰ ਲਈ ਲਚਕਦਾਰ ਹਨ ਜੋ ਅਸੀਂ ਇਹ ਲਗਾਤਾਰ ਕਰਦੇ ਰਹੀਏ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਜ਼ਿੰਦਗੀ ਵਿੱਚ ਸਾਨੂੰ ਹਰ ਰੋਜ਼ ਕੁਝ ਨਾ ਕੁਝ ਸਮਾਂ ਕੱਢ ਕੇ ਇਸ ਤਰ੍ਹਾਂ ਆਸਣ ਕਰਨੇ ਚਾਹੀਦੇ ਹਨ ਰੋਜ਼ ਸਰੀਰ ਨੂੰ ਲਚਕਤਾ ਲੈ ਆਓ